ਮੈਂ ਪਿਛਲੇ ਕੁਝ ਦਿਨਾਂ ਤੋਂ ਮੀਸ਼ੋ ਤੋਂ ਇੱਕ ਡਰੈਸ ਆਰਡਰ ਕੀਤੀ ਸੀ ਜਿਸ ਦੀ ਮੈਨੂੰ ਜੋ ਬਹੁਤ ਜਲਦੀ ਜ਼ਰੂਰਤ ਹੈ ਪਰ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਇਸ ਡਰੈਸ ਦੇ ਪਹੁੰਚਣ ਵਿੱਚ ਕੀ ਰੁਕਾਵਟ ਆ ਰਹੀ ਹੈ ਕੀ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਇਸ ਡਰੈਸ ਦੇ ਲਈ ਤੁਹਾਨੂੰ ਲੋੜੀਂਦਾ ਪਤਾ ਸਹੀ ਤਰ੍ਹਾਂ ਨਹੀਂ ਪਤਾ ਚੱਲ ਰਿਹਾ ਜਾਂ ਕੋਈ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਜਲਦੀ ਤੋਂ ਜਲਦੀ ਮੇਰੀ ਡਰੈਸ ਨੂੰ ਮੇਰੇ ਦਿੱਤੇ ਹੋਏ ਪਤੇ 'ਤੇ ਪਹੁੰਚਾਇਆ ਜਾਵੇ ਜਿਸ ਕਰਕੇ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਇਸ ਡਰੈਸ ਦੀ ਮੈਨੂੰ ਬਹੁਤ ਜਲਦੀ ਜ਼ਰੂਰਤ ਹੈ